ਸ਼ੁਰੂ ਤੋਂ ਹੀ ਪੰਜਾਬੀ ਭਾਸ਼ਾ ਸਾਡੇ ਵਿਰਸੇ ਵਿੱਚ ਵਿਚਰਦੀ ਆਈ ਹੈ ਜਿਵੇਂ ਜਿਵੇਂ ਸਮਾਂ ਵੱਧ ਰਿਹਾ ਹੈ ਪੰਜਾਬੀ ਭਾਸ਼ਾ ਦਾ ਰੁਝਾਨ ਵੀ ਓਨਾ ਹੀ ਵੱਧ ਰਿਹਾ ਹੈ ਅੱਜ ਕੱਲ੍ਹ ਦੇ ਛੋਟੇ ਛੋਟੇ ਬੱਚੇ ਵੀ ਪੰਜਾਬੀ ਬੋਲਣ ਅਤੇ ਸਿੱਖਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਹਨਾਂ ਪੰਜਾਬੀ ਬੋਲਾਂ ਅਤੇ ਸ਼ਬਦਾਂ ਦੀ ਜਾਣਕਾਰੀ ਲੈਂਦੇ ਹਨ ਅਤੇ ਆਪਣੇ ਵੱਡਿਆਂ ਨਾਲ ਵੀ ਪੰਜਾਬੀ ਵਿੱਚ ਗੱਲ ਕਰਦੇ ਹਨ

ਪੰਜਾਬੀ ਵਿਰਸੇ ਵਿੱਚ ਅੱਜ ਕੱਲ੍ਹ ਬਹੁਤ ਸਾਰੇ ਇੱਦਾਂ ਦੇ ਗਾਣੇ ਬਣ ਰਹੇ ਹਨ ਜਿਨ੍ਹਾਂ ਨਾਲ ਬੱਚਿਆਂ ਨੂੰ ਅਤੇ ਅੱਜ ਕੱਲ੍ਹ ਦੀ ਨੌਜਵਾਨ ਪੀੜੀ ਨੂੰ ਵੀ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਇਹਨਾਂ ਵਿੱਚ ਕੁਛ ਇੱਦਾਂ ਦੇ ਟੋਪਿਕ ਵੀ ਹਨ ਜੋ ਕਿ ਅੱਗੇ ਅਗਲੀ ਪੀੜੀ ਨੂੰ ਸਮਝਾਉਣ ਦੀ ਵੀ ਲੋੜ ਹੈ ਪੰਜਾਬੀ ਭਾਸ਼ਾ ਵਿੱਚ ਕਾਫੀ ਇਸ ਤਰ੍ਹਾਂ ਦੇ ਵਿਸ਼ੇ ਹਨ ਜੋ ਕਿ ਅੱਜ ਦੀ ਪੀੜੀ ਸਿੱਖ ਵੀ ਰਹੀ ਹੈ ਅਤੇ ਕੁਛ ਨਹੀਂ ਵੀ ਸਿੱਖ ਰਹੀ ਉਹਨਾਂ ਨੂੰ ਸਿੱਖਣ ਦਾ ਚਾਅ ਅਤੇ ਰੁਝਾਨ ਪਾਉਣਾ ਚਾਹੀਦਾ ਹੈ ਅਤੇ ਪੰਜਾਬੀ ਅ ਅੱਜ ਕੱਲ੍ਹ ਆਮ ਬੋਲਚਾਲ ਪੰਜਾਬੀ ਤਾਂ ਅਸੀਂ ਸਭ ਬੋਲ ਲੈਂਦੇ ਹਨ ਬਟ ਕਾਫੀ ਜ਼ਿਆਦਾ ਵਿਸ਼ੇ ਇੱਦਾਂ ਦੇ ਵੀ ਹਨ ਜੋ ਕਿ ਸਿੱਖਣ ਤੋਂ ਹਾਲੇ ਰਹਿ ਗਏ ਹਨ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਸਿੱਖੀਏ ਅਤੇ ਆਪਣੇ ਵਿਰਸੇ ਵਿੱਚ ਰੁੱਝੀਏ